ਹਾਂ ਜਦੋਂ ਮੇਰੇ ਸਾਡੇ ਸਕੂਲ ਵਿੱਚ ਦਸਵੀਂ ਵਿੱਚ ਮੈਂ ਪੜ੍ਹਦਾ ਸੀ ਉਦੋਂ ਸਪੋਰਟਸ ਡੇਅ ਵਾਲੇ ਦਿਨ ਸਾਡੇ ਸਕੂਲ ਵਿੱਚ ਮੈਰਾਥਨ ਦੌੜ ਹੋਈ ਅਤੇ ਮੈਂ ਉਹਦੇ ਵਿੱਚ ਹਿੱਸਾ ਲਿਆ ਅਤੇ ਕੁਛ ਬੱਚਿਆਂ ਨੇ ਵੀ ਬਹੁਤ ਜ਼ਿਆਦਾ ਹਿੱਸਾ ਲਿਆ ਅਤੇ ਜਦੋਂ ਰੇਸ ਸ਼ੁਰੂ ਹੋਈ ਤਾਂ ਮੈਂ ਬਹੁਤ ਤੇਜ਼ ਭੱਜਿਆ ਅੱਧੇ ਰਸਤੇ ਵਿੱਚ ਹੀ ਮੈਨੂੰ ਸਾਹ ਚੜ ਗਿਆ ਅਤੇ ਮੈਂ ਡਿੱਗ ਪਿਆ ਅਤੇ ਮੇਰੇ ਤੋਂ ਜਿਹੜੇ ਪਿੱਛੇ ਸੀਗੇ ਉਹ ਅੱਗੇ ਪਿੱਛੇ ਬੱਚੇ ਸੀ ਉਹ ਅੱਗੇ ਬੱਚੇ ਨ ਅੱਗੇ ਲੰਘ ਗਏ ਅਤੇ ਮੇਰੇ ਦੋਸਤਾਂ ਨੇ ਮੈਨੂੰ ਮੋਟੀਵੇਟ ਕੀਤਾ ਅਤੇ ਫਿਰ ਮੈਂ ਖੜ੍ਹਾ ਹੋ ਕੇ ਫਿਰ ਮੈਂ ਭੱਜਿਆ ਮੈਂ ਬਹੁਤ ਜ਼ਿਆਦਾ ਤੇਜ਼ ਉਸ ਭੱਜ ਕੇ ਵੀ ਦੂਸਰੇ ਸਥਾਨ 'ਤੇ ਆਇਆ ਇਸ ਇਸ ਵਿੱਚ ਮੈਨੂੰ ਮੇਰੇ ਅਧਿਆਪਕਾਂ ਨੇ ਅਤੇ ਮੇਰੇ ਮਾਪਿਆਂ ਨੇ ਮੈਨੂੰ ਬਹੁਤ ਵਧੀਆ ਕਿਹਾ ਅਤੇ ਮੈਂ ਦੂਜੇ ਸਥਾਨ 'ਤੇ ਆ ਕੇ ਇੱਕ ਇੱਕ ਵਧੀਆ ਪੱਧਰ ਕਰ ਪੱਧਰ ਪੇਸ਼ ਕਰ ਦਿੱਤਾ ਅਤੇ ਜਦੋਂ ਵੀ ਸਾਡੇ ਸਕੂਲ ਵਿੱਚ ਮੈਰਾਥਨ ਦੌੜ ਜਾਂ ਕੁਛ ਵੀ ਹੋਰ ਸਟੇਟ ਬਾਰੇ ਹੁਦ ਗੱਲ ਹੁੰਦੀ ਸੀ ਜਾਂ ਸਪੋਰਟਸ ਡੇਅ ਵਾਲੇ ਦਿਨ ਖੇਡ ਹੁੰਦੀ ਸੀ ਤਾਂ ਮੈਂ ਉਹਦੇ ਵਿੱਚ ਹਿੱਸਾ ਲੈਂਦਾ ਸੀ ਇੱਦਾਂ ਇੱਦਾਂ ਕਰਕੇ ਸਾਡਾ ਮੇਰਾ ਮੋਟੀਵੇਟ ਵਧ ਗਿਆ ਇਸ ਵਿੱਚ ਮੈਂ ਮੈਰਾਥਨ ਦੌੜ ਵਿੱਚ ਚਾਰ ਸੌ ਕਿਲੋਮੀਟਰ ਦੀ ਦੌੜ ਵਿੱਚ ਵੀ ਦੂਸਰੇ ਹੀ ਸਥਾਨ 'ਤੇ ਮੈਂ ਪਹੁੰਚਿਆ